ਜੇ ਆਪਾਂ ਗੱਲ ਖੇਡਾਂ ਦੀ ਕਰੀਏ ਤਾਂ ਖੇਡਾਂ ਜਿਵੇਂ ਕਿ ਕਈ ਤਰ੍ਹਾਂ ਦੀਆਂ ਸੋ ਜਿਹੜੀ ਖੇਡਾਂ ਜਦੋਂ ਆਪਾਂ ਕੋਈ ਵੀ ਖੇਡ ਖੇਡਦੇ ਹਾਂ ਉਹ ਇੱਕ ਤਾਂ ਆਪਣੇ ਸਰੀਰ ਦੀਆਂ ਸਰੀਰ ਨੂੰ ਰਿਸ਼ਟ ਪੁਸ਼ਟ ਬਣਾਉਂਦੀ ਆ ਇੱਕ ਆਪਣੀ ਦਿਮਾਗੀ ਤੌਰ 'ਤੇ ਵੀ ਖੇਡਾਂ ਕਈ ਬਣੀਆਂ ਜਿਹੜਾ ਆਪਣੇ ਦਿਮਾਗ ਨੂੰ ਜਿਹੜਾ ਰਿਸ਼ਟ ਪੁਸ਼ਟ ਕਰਦੀਆਂ ਸੋ ਆਪਣੇ ਜਿਹੜੇ ਪੇਂਡੂ ਲੋਕਾਂ ਦੀ ਜਿਹੜੀ ਰਾਏ ਆ ਉਹ ਤਕਰੀਬਨ ਤੁਸੀ ਪਿੰਡਾਂ ਦੇ ਵਿੱਚ ਵੀ ਦੇਖਿਆ ਹੋਣਾ ਬੀ ਜ਼ਿਆਦਾਤਰ ਲੋਕ ਜਿਹੜੇ ਆ ਖਾਣ ਪੀਣ ਦੇ ਪੰਜਾਬੀ ਜਿਹੜੇ ਲੋਕ ਆ ਪਿੰਡਾਂ ਦੇ ਜਿਹੜੇ ਖਾਣ ਪੀਣ ਦੇ ਜ਼ਿਆਦਾ ਸ਼ੌਕੀਨ ਹੁੰਦੇ ਸ਼ੁਰੂ ਤੋਂ ਹੀ ਸੋ ਇਹਨਾਂ ਦੀ ਜਿਹੜੀ ਸਿਹਤ ਵੀ ਆ ਸਰੀਰਿਕ ਪੱਖੋਂ ਵੀ ਇਹ ਪੂਰੇ ਮਜ਼ਬੂਤ ਸਡੋਲ ਅਤੇ ਪੂਰੇ ਲੰਬੇ ਚੌੜੇ ਹੁੰਦੇ ਆ ਕਿਉਂਕਿ ਇਹਨਾਂ ਦਾ ਖਾਣ ਪੀਣ ਵਧੀਆ ਅਤੇ ਇਹ ਕੰਮ ਵੀ ਜਿਹੜਾ ਖੇਤਾਂ ਦੇ ਵਿੱਚ ਬਹੁਤ ਇਹਨਾਂ ਨੂੰ ਕਰਨਾ ਪੈਂਦਾ ਜਾਂ ਕਰਦੇ ਰਹੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਸੋ ਜਦੋਂ ਕੰਮ ਕਰਕੇ ਬਾਅਦ ਦੇ ਵਿੱਚ ਵੀ ਇਹਨਾਂ ਨੇ ਖੇਡਾਂ ਪ੍ਰਤੀ ਵੀ ਆਪਣੀ ਰੁਚੀ ਨੂੰ ਜਿਹੜਾ ਆ ਘਟਣ ਨਹੀਂ ਦਿੱਤਾ ਕੋਈ ਨਾ ਕੋਈ ਖੇਡ ਵੀ ਖੇਡਦੇ ਰਹੇ ਆ ਜਿੱਦਾਂ ਕਿ ਆਪਾਂ ਲਾ ਲਈਏ ਕੁਸ਼ਤੀ ਹੋਈ ਰੈਸਲਿੰਗ ਕੁਸ਼ਤੀ ਜਿਹੜੀਆਂ ਕੁਸ਼ਤੀਆਂ ਕਰਦੇ ਰਹੇ ਘੋਲ ਇੱਕ ਦੂਜੇ ਦੇ ਨਾਲ ਘੁਲਣਾ ਇਹੋ ਜਿਹੀਆਂ ਜਿਹੜੀਆਂ ਖੇਡਾਂ ਆ ਜਾਂ ਮਾਂ ਖੇਡ ਜਿਹੜੀ ਪੰਜਾ ਪੰਜਾਬ ਦੀ ਮਾਂ ਖੇਡ ਕਬੱਡੀ ਆ ਕਬੱਡੀ ਵੀ ਖੇਡਦੇ ਆ ਇਹ ਵੀ ਪਿੰਡ ਪਿੰਡਾਂ ਦੇ ਲੋਕ ਹੀ ਜ਼ਿਆਦਾ ਜਿਹੜੇ ਆ ਉੱਠ ਕੇ ਅੱਗੇ ਆਏ ਜਿਹੜੀ ਕਬੱਡੀ ਜ਼ਿਆਦਾਤਰ ਤੁਸੀਂ ਦੇਖੋਗੇ ਖੇਡਦੇ ਆ ਕਬੱਡੀ ਪਿੰਡਾਂ ਦੇ ਲੋਕ ਹੀ ਖੇਡਦੇ ਆ ਸੋ ਜਿਹੜੀ ਪੇਂਡੂ ਲੋਕਾਂ ਦੀ ਰਾਏ ਇਹੀ ਆ ਵੀ ਉਹ ਜਿਹੜਾ ਖੇਡਾਂ ਪ੍ਰਤੀ ਸਭ ਤੋਂ ਵਧੀਆ ਰਹੇ ਆ ਵੀ ਲੋਕ ਜਿਹੜੇ ਵੱਧ ਤੋਂ ਵੱਧ ਖੇਡਣ ਆਪਣੇ ਸਰੀਰ ਨੂੰ ਜਿਹੜਾ ਵਾ ਰਿਸ਼ਟ ਪੁਸ਼ਟ ਰੱਖਣ ਵਧੀਆ ਤਾਕਤਵਰ ਸਰੀਰ ਹੋਵੇ ਸੋ ਆਪਣੀ ਜਿਹੜੀ ਜ਼ਿੰਦਗੀ ਆ ਸਰੀਰ ਆ ਉਹਨੂੰ ਕੋਈ ਰੋਗ ਨਹੀ ਲੱਗਦਾ ਜੇ ਵਧੀਆ ਰਿਸ਼ਟ ਪੁਸ਼ਟ ਹੋਵੇਗਾ ਸੋ ਆਪਾਂ ਰੋਗਾਂ ਤੋਂ ਵੀ ਮੋ ਮੁਕਤੀ ਹੋ ਮਿਲੇਗੀ ਆਪਾਂ ਨੂੰ ਸੋ ਪੇਂਡੂ ਲੋਕਾ ਲੋਕਾਂ ਦੀ ਇਹੀ ਰਾਏ ਆ ਵੀ ਵੱਧ ਤੋਂ ਵੱਧ ਜਿਹੜਾ ਸਰੀਰ ਨੂੰ ਵਧੀਆ ਢੰਗ ਦੇ ਨਾਲ ਆਪਾਂ ਰਿਸ਼ਟ ਪੁਸ਼ਟ ਰੱਖ ਸਕੀਏ